ਮੈਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦੀ ਵਸਨੀਕ ਹਾਂ ਸਾਡੇ ਜ਼ਿਲ੍ਹੇ ਵਿੱਚ ਘੁੰਮਣ ਲਈ ਬਹੁਤ ਹੀ ਜਗ੍ਹਾ ਹੈ ਹਨ ਸਾਡੇ ਘਰ ਦੇ ਨੇੜੇ ਟਿੱਬੀ ਸਾਹਿਬ ਵੀ ਹੈ ਜੋ ਕਿ ਸਾਡੇ ਘਰ ਦੇ ਬਹੁਤ ਨੇੜੇ ਹੈ ਉੱਥੇ ਘੁੰਮਣ ਲਈ ਬਹੁਤ ਸਾਰੀਆਂ ਜਗ੍ਹਾ ਹਨ ਜੋ ਕਿ ਬਹੁਤ ਵਧੀਆ ਹਨ ਲੋਕ ਉੱਥੇ ਜਾਣ ਲਈ ਬਹੁਤ ਦੂਰ ਦੂਰ ਤੋਂ ਆਉਂਦੇ ਹਨ ਅਸੀਂ ਚਸ਼ਮਿਆਂ ਵੀ ਘੁੰਮਣ ਜਾਂਦੇ ਹਾਂ ਉੱਥੇ ਪੀਰਾਂ ਦੀ ਬਹੁਤ ਬੜੀ ਮਜਾਰ ਹੈ ਉੱਥੇ ਮੇਲੇ ਵੀ ਲੱਗਦੇ ਨੇ ਲੋਕ ਉਸਦਾ ਆਨੰਦ ਵੀ ਮਾਣਦੇ ਹਨ ਸ਼ਹੀਦ ਭਗਤ ਸਿੰਘ ਨਗਰ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਪਿੰਡ ਖਟਕੜ ਕਲਾਂ ਹੈ ਜਿੱਥੇ ਇੱਕ ਮਿਊਜ਼ੀਅਮ ਵੀ ਹੈ ਜਿਸ ਵਿੱਚ ਸ਼ਹੀਦ ਭਗਤ ਸਿੰਘ ਜੀ ਦੀਆਂ ਬਹੁਤ ਵਸਤੂਆਂ ਰੱਖੀਆਂ ਹਨ ਜਿਨ੍ਹਾਂ ਨੂੰ ਵੇਖਣ ਲਈ ਲੋਕ ਬਹੁਤ ਦੂਰ ਦੂਰ ਤੋਂ ਆਉਂਦੇ ਹਨ ਉਹਨਾਂ ਤੋਂ ਅਸੀਂ ਜ਼ਿੰਦਗੀ ਤੋਂ ਸਹੀ ਸੇਧ ਦਿੰਦੇ ਨੇ ਇਸੇ ਤਰ੍ਹਾਂ ਸਾਡੇ ਖੇਤਰ ਵਿੱਚ ਬਹੁਤ ਹੋਰ ਵੀ ਸਾਰੇ ਭਗਤ ਨੇ ਜੋ ਕਿ ਬਹੁਤ ਵਧੀਆ ਨੇ ਇਸੇ ਤਰ੍ਹਾਂ ਸਾਡੇ ਘਰ ਦੇ ਨੇੜੇ ਮਧੂਵਨ ਪਾਰਕ ਹੈ ਜਿਸ ਵਿੱਚ ਬਹੁਤ ਸ ਤਰ੍ਹਾਂ ਦੇ ਫੁੱਲ ਨੇ ਬੱਚਿਆਂ ਨੂੰ ਖੇਡਣ ਲਈ ਝੂਲੇ ਨੇ ਅਤੇ ਸ਼ਾਮ ਨੂੰ ਇਸ ਵਿੱਚ ਸੰਗੀਤ ਦਾ ਵੀ ਪੂਰਾ ਪ੍ਰਬੰਧ ਹੈ